ਖੇਡਾਂ ਖੇਡਣਾ ਲੋਕਾਂ ਲਈ ਬਹੁਤ ਵਧੀਆ ਹੁੰਦੀ ਹੈ ਜੇ ਅਸੀਂ ਖੇਡਾਂ ਖੇਡਦੇ ਹਾਂ ਸਾਡਾ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਹੈ ਸਾਨੂੰ ਜਿਹੜੀ ਅਮ ਉੱਥੋਂ ਦੀ ਹਵਾ ਜਿੱਥੇ ਆਪਾਂ ਖੇਡਣ ਜਾਣਾ ਖੇਡਾਂ ਖੇਡਦੇ ਹਾਂ ਹੈ ਨਾ ਉੱਥੋਂ ਦੀ ਤੰਦਰੁਸਤ ਹਵਾ ਮਿਲਦੀ ਆਕਸੀਜਨ ਮਿਲਦੀ ਹੈ ਜਿਹਦੇ ਨਾਲ ਸਾਡੀ ਜਿਹੜੀ ਸਿਹਤ ਬਹੁਤ ਵਧੀਆ ਰਹਿੰਦੀ ਹੈ ਹੈ ਨਾ ਇੱਕ ਖੇਡਾਂ ਖੇਡਣ ਨਾਲ ਅਸੀਂ ਫਿਟ ਰਹਿੰਦੇ ਹਾਂ ਸਾਨੂੰ ਬਹੁਤਾ ਸਾਹ ਨਹੀਂ ਚੜ੍ਹਦਾ ਨਾ ਕਿਸੇ ਤਰ੍ਹਾਂ ਦੀ ਬਿਮਾਰੀ ਹੋਣ ਦਾ ਡਰ ਹੁੰਦਾ ਹੈ ਨਾ ਕਿਉਂਕਿ ਅਸੀਂ ਆਪਾਂ ਡੇਲੀ ਰੂਟੀਨ 'ਚ ਆਪਾਂ ਫਿਟ ਰਹਿੰਦੇ ਹਾਂ ਆਪਣੇ ਸਰੀਰ ਨੂੰ ਲੈ ਕੇ ਹੈ ਨਾ ਅਤੇ ਜੇ ਆਪਾਂ ਗੱਲ ਕਰ ਲਈਏ ਸਰੀਰਕ ਖੇਡਾਂ ਦੀ ਉਹਦੇ ਵਿੱਚ ਤਾਂ ਸਾਡਾ ਸਰੀਰ ਫਿੱਟ ਰਹਿੰਦਾ ਹੈ ਨਾ ਸਾਡੀ ਹੱਡੀਆਂ ਹੁੱਡੀਆਂ ਸਭ ਕੁਛ ਐਨ ਵਧੀਆ ਰਹਿੰਦਾ ਸਰੀਰ ਸਾਰਾ ਅਤੇ ਤੰਦਰੁਸਤੀ ਹੁੰਦੀ ਹੈ ਸਾਡੇ ਸਰੀਰ 'ਚ ਐਂ ਨਹੀਂ ਕਿ ਦੇਜੀਪੂਣਾ ਜਿਹਾ ਕਰਕੇ ਬੈਠੇ ਰਹੋ ਥੋੜ੍ਹਾ ਜਿਹਾ ਕੰਮ ਕੀਤਾ ਤਾਂ ਉੱਥੇ ਡਿੱਗ ਜਾਉ ਥੋੜ੍ਹਾ ਜਿਹਾ ਕੰਮ ਕੀਤਾ ਤਾਂ ਉੱਥੇ ਡਿੱਗ ਜਾਉ ਇੱਦਾਂ ਦਾ ਨਹੀਂ ਹੁੰਦਾ ਅਸੀਂ ਸਾਡੇ ਸਰੀਰ 'ਚ ਐਨੀ ਕੁ ਐਨਰਜੀ ਹੁੰਦੀ ਕਿ ਅਸੀਂ ਸਾਰਾ ਫਟਾਫਟ ਕੰਮ ਕਰਕੇ ਆਪਣਾ ਫਰੀ ਹੋ ਜਾਂਦੇ ਹਾਂ ਅਤੇ ਸਾਡਾ ਜਿਹੜਾ ਦਿਮਾਗ ਉਦੋਂ ਵੀ ਐਕਟਿਵ ਰਹਿੰਦਾ ਕਿ ਅਸੀਂ ਕੁਛ ਕਰੀਏ ਹੈ ਨਾ ਕੀ ਕਰੀਏ ਕਿੱਦਾਂ ਕਰੀਏ ਸਾਰਾ ਕੁਛ ਹੁੰਦਾ ਅਤੇ ਜੇ ਆਪਾਂ ਮਾਨਸਿਕ ਦੀ ਤੰਦਰੁਸਤੀ ਦੀ ਗੱਲ ਕਰ ਲਈਏ ਉਹਦੇ ਵਿੱਚ ਸਾਨੂੰ ਰਹਿਣ ਸਹਿਣ ਹੈ ਨਾ ਪਤਾ ਲੱਗ ਜਾਂਦਾ ਹੈ ਸਾਡੀਆਂ ਖੇਡਾਂ ਦੇ ਵਿੱਚ ਸਾਡੇ ਨਾਲ ਜਿਹੜੇ ਲੋਕ ਹੁੰਦੇ ਇਕੱਠੇ ਅਸੀਂ ਰਹਿੰਦੇ ਇਕੱਠੇ ਰਹਿਣਾ ਸਿੱਖ ਜਾਦੇ ਹਾਂ ਸਾਡਾ ਜਿਹੜਾ ਕੈਪਟਨ ਹੁੰਦਾ ਹੈ ਉਹਦੇ ਦੌਰਾਨ ਸਾਨੂੰ ਖੇਡਾਂ ਕਿਵੇਂ ਖੇਡੀਆਂ ਜਾਂਦੀਆਂ ਉਹ ਸਿਖਾਇਆ ਜਾਂਦਾ ਅਤੇ ਬੋਲਣਾ ਕਿਵੇਂ ਹੈ ਉਹ ਸਾਰੀਆਂ ਗੱਲਾਂ ਸਿਖਾਈਆਂ ਜਾਂਦੀਆਂ ਅਤੇ ਜਿਵੇਂ ਹੋਰ ਵੀ ਕਈ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਜਿਹੜੀਆਂ ਸਾਡੇ ਲਈ ਬਹੁਤ ਵਧੀਆ ਹੁੰਦੀਆਂ ਲਾਭਦਾਇਕ ਹੁੰਦੀਆਂ ਹੈ ਨਾ ਅਤੇ ਜਿਹੜੀਆਂ ਸਾਡੇ ਸਰੀਰ ਨੂੰ ਫਿੱਟ ਵੀ ਰੱਖਦੀਆਂ ਆ ਹੋਰ ਇੰਨੇ ਬਹੁਤ ਸਾਰੀਆਂ ਚੀਜ਼ਾਂ ਬਾਰੇ ਸਾਨੂੰ ਦੱਸਿਆ ਜਾਂਦਾ ਤਾਂ ਇਸ ਲਈ ਸਾਨੂੰ ਖੇਡਾਂ ਜਿਹੜੀਆਂ ਖੇਡਣੀਆਂ ਚਾਹੀਦੀਆਂ ਜਿਹਦੇ ਨਾਲ ਸਾਨੂੰ ਬਹੁਤ ਵਧੀਆ ਫਾਇਦੇ ਹੁੰਦੇ ਨੇ